ਇੱਕੀ ਜੁਲਾਈ ਤੇਰ੍ਹਾਂ ਸੌ ਉਣਹੱਤਰ ਪੰਜ ਸਪਤੰਬਰ ਦੋ ਹਜ਼ਾਰ ਤੇਈ ਪੰਜੀ ਦਸੰਬਰ ਦੋ ਹਜ਼ਾਰ ਅੱਠ ਅੱਠ ਸਤੰਬਰ ਦੋ ਹਜ਼ਾਰ ਪੰਜ ਉੱਨੀ ਫਰਵਰੀ ਉੱਨੀ ਸੌ ਸੱਤਰ